ਹਾਂਜੀ ਇੱਕ ਬਾਰ ਨਾ ਹਾਈਕਿੰਗ ਦੇ ਦੌਰਾਨ ਮੈਂ ਗਿਆ ਸੀਗਾ ਇੱਥੇ ਜਾਮਲੀ ਦੇ ਕੋਲ ਏਰੀਆ ਹਿਮਾਚਲ ਦੇ ਵਿੱਚ ਜਿਹੜਾ ਟਰੈਕ ਰੂਟ ਹੈ ਉਹ ਕਰੀਬ ਕਰੀਬ ਸੱਤ ਕਿਲੋਮੀਟਰ ਦਾ ਅਤੇ ਇਹ ਜਾ ਕੇ ਫਿਰ ਕਸੌਲੀ ਨਿਕਲਦਾ ਅਤੇ ਅਸੀਂ ਪੰਜ ਜਣੇ ਸੀ ਜਦੋਂ ਉੱਥੇ ਗਏ ਤਾਂ ਅਸੀਂ ਮੈਕਡੋਨਲ 'ਤੇ ਪਹੁੰਚੇ ਮੈਕਡੋਨਲ 'ਤੇ ਕੁਝ ਖਾ ਪੀ ਕੇ ਫਿਰ ਅਸੀਂ ਆਪਣਾ ਸਫ਼ਰ ਸਟਾਰਟ ਕੀਤਾ ਅਤੇ ਬੈਗ ਦੇ ਵਿੱਚ ਪਾਣੀ ਦੀ ਬੋਤਲਾਂ ਸੀ ਸਾਡੇ ਕੋਲ ਅਤੇ ਨਾਲ ਦੋ ਚਾਰ ਜਿਵੇਂ ਖਾਣ ਪੀਣ ਦਾ ਛੋਟਾ ਛੋਟਾ ਸਮਾਨ ਸੀ ਹਾਈਕਿੰਗ ਸ਼ੁਰੂ ਕੀਤੀ ਅਤੇ ਅਸੀਂ ਤ ਤਿੰਨ ਜਣੇ ਅੱਗੇ ਚੱਲ ਰਹੇ ਸੀ ਦੋ ਜਣੇ ਪਿੱਛੇ ਚੱਲ ਰਹੇ ਸੀਗੇ ਮੈਂ ਉਹ ਪਿੱਛੇ ਵਾਲੇ ਮੈਂਬਰ ਦੇ ਨਾਲ ਸੀਗਾ ਅਤੇ ਉਹ ਤਿੰਨ ਮੈਂਬਰ ਜਿਹੜੇ ਅੱਗੇ ਅੱਗੇ ਜਾ ਰਹੇ ਸੀ ਉਹਨਾਂ ਨੂੰ ਹੀ ਉਹਨਾਂ 'ਚੋਂ ਇੱਕ ਮੈਂਬਰ ਨੂੰ ਰਸਤਾ ਪਤਾ ਸੀ ਉਹ ਵਾਈ ਚਾਂਸ ਕਿੱਥੇ ਨਾ ਇਹੋ ਜਿਹਾ ਮੋੜ ਆਇਆ ਜਿੱਥੇ ਦੋ ਦੋ ਮੋੜ ਦੋਰਾਹਾ ਜਿਹਾ ਟਾਈਪ 'ਤੇ ਉਹ ਤਿੰਨ ਜਣੇ ਅੱਗੇ ਨਿਕਲ ਗਏ ਅਤੇ ਅਸੀਂ ਦੋ ਜਣੇ ਪਿੱਛੇ ਪਿੱਛੇ ਆ ਰਹੇ ਸੀਗੇ ਉਹ ਆਪਣੀਆਂ ਗੱਲਾਂ ਮਾਰਦੇ ਮਾਰਦੇ ਉਹਨਾਂ ਨੇ ਪਿੱਛੇ ਨਹੀਂ ਦੇਖਿਆ ਅਸੀਂ ਜ਼ਿਆਦਾ ਫਾਸਟ ਨਹੀਂ ਹੋਏ ਤਾਂ ਹੋਇਆ ਕੀ ਉਹ ਦੋਰਾਹੇ 'ਤੇ ਆ ਕੇ ਅਸੀਂ ਦੇਖਣ ਲੱਗੇ ਵੀ ਸੱਜੇ ਜਾਈਏ ਜਾਂ ਖੱਬੇ ਜਾਈਏ ਤਾਂ ਉਹ ਸਾਨੂੰ ਤਿੰਨੋਂ ਬੰਦੇ ਨਜ਼ਰ ਨਾ ਆਉਣ ਤਾਂ ਉਸ ਟਾਈਮ ਫਿਰ ਅਸੀਂ ਆਈਡੀਆ ਦੇ ਨਾਲ ਅੱਛਾ ਉੱਧਰ ਮੋਬਾਈਲ ਦਾ ਨੈਟਵਰਕ ਕੰਮ ਨਹੀਂ ਕਰ ਰਿਹਾ ਸੀ ਅਤੇ ਸਾਨੂੰ ਹੁਣ ਲੱਗਿਆ ਹੁਣ ਅਸੀਂ ਕਿਹੜੇ ਪਾਸੇ ਜਾਈਏ ਅਸੀਂ ਫਿਰ ਆਪਣਾ ਅੱਕੜ ਦੁੱਕੜ ਜਿਹੀ ਕੀਤੀ ਉਹਦੇ ਹਿਸਾਬ ਨਾਲ ਜਿਹੜਾ ਰੱਫ ਜਿਹਾ ਟੱਫ ਜਿਹਾ ਆਈਡੀਆ ਲਗਾਇਆ ਡਾਇਰੈਕਸ਼ਨ ਹੀ ਸੋਚੀ ਅਤੇ ਅਸੀਂ ਉੱਧਰ ਜਿੱਧਰ ਜਾਣਾ ਚਾਹੀਦਾ ਸੀਗਾ ਸੱਜੇ ਪਾਸੇ ਉਹਦੀ ਬਜਾਏ ਅਸੀ ਖੱਬੇ ਪਾਸੇ ਚਲੇ ਗਏ ਉਹ ਖੱਬੇ ਪਾਸੇ ਜਦੋਂ ਅਸੀਂ ਚੱਲੇ ਥੋੜ੍ਹਾ ਚੱਲਣ ਤੋਂ ਬਾਅਦ ਸਾਨੂੰ ਲੱਗਿਆ ਵੀ ਰਸਤਾ ਤਾਂ ਗਲਤ ਆ ਗਏ ਪਰ ਹੁਣ ਸਾਨੂੰ ਸਮਝ ਨਾ ਆਵੇ ਕਿ ਵਾਪਸ ਕਿੱਧਰ ਜਾਈਏ ਕਿਹੜੇ ਪਾਸੇ ਜਾਈਏ ਵੀ ਉਸ ਇਹ ਰਸਤਾ ਠੀਕ ਵੀ ਹੈ ਕਿ ਨਹੀਂ ਹੈ ਕੋਈ ਕਲੀਅਰ ਨਾ ਹੋਵੇ ਫਿਰ ਅਸੀਂ ਨਾ ਉਹ ਰੱਬ ਦਾ ਨਾਮ ਲੈ ਕੇ ਚੱਲੀ ਗਏ ਅਤੇ ਅਲਟੀਮੇਟਲੀ ਜਾ ਕੇ ਅਸੀਂ ਫਿਰ ਕਸੌਲੀ ਉਸ ਜਗ੍ਹਾ 'ਤੇ ਤਾਂ ਨਹੀਂ ਨਿਕਲੇ ਇੱਕ ਹੋਰ ਜਗ੍ਹਾ ਸੀ ਕਿ ਜਿਹੜੀ ਉੱਥੋਂ ਕਰੀਬ ਕਰੀਬ ਚਾਰ ਜਾਂ ਪੰਜ ਕਿਲੋਮੀਟਰ ਦੂਰ ਸੀਗੀ ਜਿੱਥੋਂ ਨਿਕਲਣਾ ਸੀ ਅਤੇ ਫਿਰ ਉੱਥੇ ਜਦੋਂ ਅਸੀਂ ਬਾਹਰ ਥੋੜ੍ਹਾ ਜਿਹਾ ਨਿਕਲੇ ਤਾਂ ਉੱਥੇ ਨੈਟਵਰਕ ਆਇਆ ਤਾਂ ਅਸੀਂ ਫਿਰ ਉਹ ਮੋਬਾਈਲ 'ਤੇ ਆਪਸ 'ਚ ਟਾਈ ਅਪ ਕੀਤਾ ਅਤੇ ਅਸੀਂ ਫਿਰ ਇੱਕ ਜਗ੍ਹਾ ਇਕੱਠੇ ਹੋਏ ਅਤੇ ਮੈਨੂੰ ਇਹ ਹੁਣ ਅੱਗੇ ਤੋਂ ਇਹ ਖਿਆਲ ਆਇਆ ਵੀ ਜਦੋਂ ਵੀ ਕਦੇ ਜਾਣਾ ਜਿਹੜੀ ਸਭ ਤੋਂ ਵੱਡੀ ਸਾਵਧਾਨੀ ਜਦੋਂ ਅਸੀਂ ਜਾਈਏ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਤਾਂ ਖਾਣ ਪੀਣ ਦਾ ਸਮਾਨ ਥੋੜ੍ਹਾ ਜਿਹਾ ਇੰਨਾ ਕੁ ਜ਼ਰੂਰ ਲੈ ਕੇ ਜਾਈਏ ਵੀ ਇੱਕ ਦਿਨ ਹੀ ਗੁਜਾ ਗੁਜਾਰ ਹੋ ਜਾਵੇ ਪਾਣੀ ਦੀਆਂ ਬੋਤਲਾਂ ਨਾਲ ਹੋਣ ਵਧੀਆ ਸ਼ੂਜ਼ ਪਾਏ ਹੋਣ ਜਿਹੜੇ ਟਰੈਕਿੰਗ ਸ਼ੂਜ਼ ਹੋਣ ਅਤੇ ਇੱਕ ਤੁਹਾਡੇ ਕੋਲ ਵਿੰਡ ਸ਼ੀਟਰ ਹੋਣੀ ਚਾਹੀਦੀ ਹੈ ਵੀ ਬਾਰਿਸ਼ ਹੋ ਜੇ ਤਾਂ ਉਹਦਾ ਬਚਾਅ ਹੋ ਸਕੇ ਅਤੇ ਦੂਜਾ ਜਦੋਂ ਚੱਲਣਾ ਸਾਰਿਆਂ ਨੇ ਇਕੱਠੇ ਚੱਲਣਾ ਹੈ ਅਤੇ ਇਕ ਅੱਧੀ ਕੋਈ ਰੱਸੀ ਵੀ ਨਾਲ ਲੈ ਕੇ ਜਾ ਸਕਦਾ ਹੋਵੇ ਤਾਂ ਬਹੁਤ ਵਧੀਆ ਵੀ ਜਿਵੇਂ ਪੰਜ ਬੰਦੇ ਜਾ ਰਹੇ ਆ ਤਾਂ ਉਹ ਰੱਸੀ ਪਕੜ ਲੈਣ ਅਤੇ ਰੱਸੀ ਦੇ ਨਾਲ ਜਿਹੜਾ ਪਹਿਲਾ ਬੰਦਾ ਜਿਹੜਾ ਐਜ ਏ ਗਾਈਡ ਕੰਮ ਕਰੇ ਅਤੇ ਉਹਦੇ ਪਿੱਛੇ ਪਿੱਛੇ ਸਾਰੇ ਚੱਲਦੇ ਰਹਿਣ